ਹਾਂਜੀ ਜਿਹੜੀ ਭੰਗੜੇ ਦੀ ਨਾ ਪੰਜਾਬੀਆਂ ਦੇ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈਗੀ ਪੰਜਾਬੀਆਂ ਦਾ ਤਾਂ ਕੋਈ ਵੀ ਪ੍ਰੋਗਰਾਮ ਹੋਵੇ ਨਾ ਭੰਗੜੇ ਤੋਂ ਬਿਨਾਂ ਸਿਰੇ ਨੀਗਾ ਚੜਦਾ ਗਾ ਭੰਗੜਾ ਤਾਂ ਇੱਕ ਇਹੋ ਜਿਹੀ ਚੀਜ਼ ਹੈ ਨਾ ਜਿਹੜੀ ਆਪਣੇ ਸਰੀਰ ਦੇ ਵਿੱਚ ਜੋਸ਼ ਉਮੰਗ ਐਂ ਪੂਰਾ ਹੁਲਾਰਾ ਦਿੰਦੀ ਹੈ ਬੰਦੇ ਨੂੰ ਨਾ ਬਸ ਜਦੋਂ ਐਂ ਬੰਦਾ ਪੂਰਾ ਖੁਸ਼ ਹੋ ਕੇ ਭੰਗੜਾ ਹੀ ਪਾਉਂਦਾ ਗਾ ਭੰਗੜੇ ਦਾ ਕੋਈ ਟਿਕਾਣਾ ਨੀਗਾ ਰਹਿੰਦਾ ਜੀ ਵੀ ਭੰਗੜਾ ਬੰਦਾ ਇੰਨਾ ਖੁਸ਼ ਹੋ ਕੇ ਪਾਉਂਦਾ ਨਾ ਉਹਦਾ ਜਿਹੜਾ ਖੂਨ ਆ ਨਾ ਬੰ ਬੰਦੇ ਦਾ ਐਨ ਪੂਰਾ ਵੱਧ ਜਾਂਦਾ ਉਬਾਲੇ ਮਾਰਦਾ ਹੈਗਾ ਚਿਹਰੇ 'ਤੇ ਲਾਲੀ ਆ ਜਾਂਦੀ ਉਹਦਾ ਚਿਹਰਾ ਨਾ ਐਂ ਪੂਰਾ ਖਿੜ ਖਿੜ ਜਾਂਦਾ ਜਦੋਂ ਬੰਦਾ ਭੰਗੜਾ ਪਾਉਂਦਾ ਹੈਗਾ ਭੰਗੜੇ ਦੀ ਇੰਨੀ ਜ਼ਿਆਦਾ ਮਹੱਤਤਾ ਹੈਗੀ ਸਾਡੇ ਪੰਜਾਬ ਦੇ ਵਿੱਚ ਵੀ ਕੋਈ ਵੀ ਫੰਕਸ਼ਨ ਹੈਗਾ ਭੰਗੜੇ ਤੋਂ ਬਿਨਾਂ ਅਧੂਰਾ ਹੈਗਾ ਜਿਵੇਂ ਕਿ ਹਾਂ ਹੁਣ ਤੁਸੀਂ ਦੇਖ ਲਓ ਇਹ ਪੰਚਾਇਤੀ ਚੋਣਾਂ ਹੋਈਆਂ ਹੈਗੀਆਂ ਠੀਕ ਹੈ ਨਾ ਮੈਂ ਆਪਣਾ ਇੰਸਟਾਗਰਾਮ ਖੋਲ੍ਹ ਰਿਹਾ ਸੀ ਜਿੰਨੇ ਸਰਪੰਚ ਜਿੱਤੇ ਆ ਸਾਰੇ ਭੰਗੜਾ ਪਾਈ ਜਾ ਰਹੇ ਨੇ ਉਹਨਾਂ ਦੇ ਮਗਰ ਲੋਕ ਹੈਗੇ ਉਹ ਵੀ ਉਹਨਾਂ ਦੇ ਐਂ ਪੂਰਾ ਭੰਗੜੇ ਵਾਲਾ ਮਾਹੌਲ ਬਣਿਆ ਪਿਆ ਆਸੇ ਪਾਸੇ ਅਤੇ ਜਦੋਂ ਇੰਸਟਾਗ੍ਰਾਮ 'ਤੇ ਇੱਕ ਮੈਂ ਵੀਡੀਓ ਦੇਖੀ ਉਹ ਬਾਜੇਖਾਨਾ ਗਾ ਇੱਧਰ ਬਠਿੰਡਾ ਜਿਲ੍ਹੇ ਵਿੱਚ ਉਥੋਂ ਦੇ ਸਰਪੰਚ ਨੇ ਅਤੇ ਉਹਦੇ ਘਰਆਲੀ ਨੇ ਇੰਨਾ ਸੋਹਣਾ ਭੰਗੜਾ ਪਾਇਆ ਉਹ ਇੰਨੇ ਵਾਇਰਲ ਹੋਏ ਪਏ ਆ ਪਤੰਦਰ ਬਹੁਤ ਜ਼ਿਆਦਾ ਹੀ ਵੀ ਭੰਗੜੇ ਦੀ ਤਾਂ ਬਹੁਤ ਜ਼ਿਆਦਾ ਮਹੱਤਤਾ ਹੈ ਛੋਟੀ ਤੋਂ ਛੋਟੀ ਖੁਸ਼ੀ ਅਤੇ ਵੱਡੇ ਤੋਂ ਵੱਡੀ ਖੁਸ਼ੀ ਦੇ ਵਿੱਚ ਆ ਜਿਹੜਾ ਭੰਗੜਾ ਬਹੁਤ ਖ਼ਾਸ ਮਹੱਤਤਾ ਰੱਖਦਾ ਹੈਗਾ ਠੀਕ ਹੈ ਇਹ ਨਹੀਂ ਵੀ ਭੰਗੜੇ ਲਈ ਕੋਈ ਉਡੀਕਿਆ ਜਾਂਦਾ ਜੇ ਆਪਾਂ ਨੂੰ ਕੋਈ ਖੁਸ਼ੀ ਵਾਲੀ ਨਿਊਜ਼ ਮਿਲ ਗਈ ਤਾਂ ਵੀ ਪੰਜਾਬੀ ਤਾਂ ਉਹਦੀ ਭੰਗੜਾ ਪਾ ਦਿੰਦੇ ਹੈਗੇ ਭੰਗੜੇ ਲਈ ਖ਼ਾਸ ਮਹੱਤਤਾ ਦੀ ਉਹਦੀ ਲੋੜ ਨਹੀਂ ਵੀ ਇਹ ਖ਼ਾਸ ਮੌਕੇ 'ਤੇ ਹੀ ਪਾਇਆ ਜਾਊਗਾ ਹਮੇਸ਼ਾ ਹੀ ਪਾਇਆ ਜਾਂਦਾ ਜਦੋਂ ਬੰਦਾ ਖੁਸ਼ ਹੋ ਜਾਂਦਾ ਪੰਜਾਬੀ ਤਾਂ ਉੱਥੇ ਹੀ ਫੱਟੇ ਚੁੱਕ ਦਿੰਦੇ ਆ ਪਹਿਲਾਂ ਤਾਂ ਫਸਲ ਫਸਲ ਸੋਹਣੀ ਹੋ ਗਈ ਪੰਜਾਬੀ ਤਾਂ ਭੰਗੜਾ ਪਾ ਦਿੰਦੇ ਆ ਮੱਝ ਸੂ ਪਈ ਤਾਂ ਭੰਗੜਾ ਪਾ ਦਿੱਤਾ ਜੇ ਮੱਝ ਚੰਗੀ ਲੱਖ ਦੋ ਲੱਖ ਦੀ ਵਿਕ ਗਈ ਤਾਂ ਭੰਗੜਾ ਪਾ ਦਿੱਤਾ ਜੇ ਪੰਜਾਬੀਆਂ ਦੇ ਮੁੰਡੇ ਨੂੰ ਬਾਹਰਲਾ ਵੀਜ਼ਾ ਲੱਗ ਜਾਵੇ ਤਾਂ ਪੰਜਾਬੀ ਤਾਂ ਭੰਗੜਾ ਪਾ ਦਿੰਦੇ ਆ ਵਿਆਹਾਂ ਸ਼ਾਦੀਆਂ 'ਤੇ ਤਾਂ ਪੰਜਾਬੀ ਭੰਗੜਾ ਪਾਉਂਦੇ ਹੀ ਸੀਗੇ ਲੋਹੜੀਆਂ 'ਤੇ ਹੋਲੀਆਂ ਦੇ ਮੌਕੇ 'ਤੇ ਅਤੇ ਵਿਸਾਖੀ ਦੇ ਮੌਕੇ 'ਤੇ ਹਰ ਵਾਰ ਆ ਜਿਹੜੇ ਪੰਜਾਬੀ ਆ ਭੰਗੜਾ ਪਾਉਂਦੇ ਹੈਗੇ ਭੰਗੜੇ ਦੀ ਤਾਂ ਬਹੁਤ ਜ਼ਿਆਦਾ ਮਹੱਤਤਾ ਹੈਗੀ ਪੰਜਾਬ ਦੇ ਵਿੱਚ ਜੇ ਹੁਣ ਦੇਖੀਏ ਆਪਾਂ ਇਕੱਲੇ ਪੰਜਾਬ ਦੇ ਵਿੱਚ ਨਹੀਂ ਹੁਣ ਪੰਜਾਬ ਦੇ ਜਿਹੜੇ ਸਾਡੇ ਲੋਕ ਹੈਗੇ ਕਨੇਡਾ ਅਮੈਰੀਕਾ ਵਗੈਰਾ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਜਿਹੜਾ ਭੰਗੜੇ ਨੂੰ ਜਿਹੜਾ ਕੀ ਆ ਹੋਰ ਉਤਸ਼ਾਹ ਦਿੱਤਾ ਹੈਗਾ ਉੱਥੋਂ ਦੇ ਲੋਕਾਂ ਨੂੰ ਵੀ ਆਪਣੇ ਮਗਰ ਲਗਾਇਆ ਹੈਗਾ ਵੀ ਇਹ ਸਾਡਾ ਭੰਗੜਾ ਪਾ ਨੂੰ ਦੇਖ ਆਪਣਾ ਕੇ ਤਾਂ ਦੇਖੋ ਭੰਗੜੇ ਦੇ ਵਿੱਚ ਕਿੰਨੀ ਕਸਰਤ ਹੁੰਦੀ ਹੈ ਕਿੰਨੀ ਸਰੀਰਾਂ ਦੀ ਹਲ ਹਿਲਜੁਲ ਹੁੰਦੀ ਹੈ ਲਚਕਦਾਰ ਹੁੰਦਾ ਸਾਡਾ ਸਰੀਰ ਸਾਡੇ ਸਰੀਰ ਪੂਰਾ ਐਕਟਿਵ ਰਹਿੰਦਾ ਭੰਗੜਾ ਪਾ ਕੇ ਅਤੇ ਜਿਹੜਾ ਪੰਜਾਬ ਦੇ ਵਿੱਚ ਹੀ ਨਹੀਂ ਜਿਵੇਂ ਆਪਣਾ ਪੰਜਾਬੀ ਦਾ ਪ੍ਰਸਿੱਧ ਗਾਇਕ ਹੈਗਾ ਦਲਜੀਤ ਦੋਸਾਂਝ ਹੁਣ ਇਹ ਭੰਗੜੇ ਨੂੰ ਜਿਹੜਾ ਕਿ ਨੈਸ਼ਨਲ ਨਹੀਂ ਗਾ ਸਗੋਂ ਇੰਟਰਨੈਸ਼ਨਲ ਲੈਵਲ 'ਤੇ ਵੀ ਲੈ ਕੇ ਗਿਆ ਹੈਗਾ ਭੰਗੜੇ ਨੂੰ ਆਪਣੇ ਨੂੰ ਤਾਂ ਇਸ ਲਈ ਆਪਾਂ ਐਂ ਵੀ ਨਹੀਂ ਕਹਿ ਸਕਦੇ ਜਿਹੜਾ ਆਪਣਾ ਭੰਗੜਾ ਹੈਗਾ ਇਕੱਲੇ ਪੰਜਾਬ ਦੇ ਵਿੱਚ ਹੀ ਪਾਇਆ ਜਾਂਦਾ ਨਹੀਂ ਭੰਗੜਾ ਤਾਂ ਹੁਣ ਦੁਨੀਆਂ ਭਰ ਦੇ ਵਿੱਚ ਹੀ ਪਾਇਆ ਜਾਂਦਾ ਹੈਗਾ ਅਤੇ ਕੋਈ ਵੀ ਜਿਹੜਾ ਤਿਥ ਤਿਉਹਾਰ ਹੈਗਾ ਕਿਉਂਕਿ ਪੰਜਾਬੀ ਹੁਣ ਸਾਰੇ ਹਰ ਇੱਕ ਕੋਨੇ 'ਤੇ ਗਏ ਉਹ ਆਪਣੇ ਨਾਲ ਆਪਣੇ ਭੰਗੜੇ ਨੂੰ ਲੈ ਗਏ ਅਤੇ ਉਹਨਾਂ ਨੇ ਖੁਦ ਵੀ ਭੰਗੜਾ ਪਾਇਆ ਅਤੇ ਸਾਰੀ ਦੁਨੀਆਂ ਨੂੰ ਭੰਗੜਾ ਪਾਉਣ ਲਾ ਦਿੱਤਾ ਇਸ ਲਈ ਜਿਹੜਾ ਭੰਗੜੇ ਦੀ ਬਹੁਤ ਜ਼ਿਆਦਾ ਮਹੱਤਤਾ ਹੈਗੀ ਧੰਨਵਾਦ ਜੀ